ਪੰਜਾਬੀ ਭਾਸ਼ਾ ਦੀ ਤੁਲਨਾ ਹੋਰ ਭਾਸ਼ਾਵਾਂ ਨਾਲ਼ ਕੀਤੀ ਹੀ ਨਹੀਂ ਜਾ ਸਕਦੀ ਕਿਉਂਕਿ ਜੋ ਮਿਠਾਸ ਆਪਣੀ ਪੰਜਾਬੀ ਭਾਸ਼ਾ ਵਿੱਚ ਹੈ ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਦੇਖੀ ਜਾਂਦੀ ਪੰਜਾਬ ਦੇ ਲੋਕ ਪੰਜਾਬੀ ਇੰਨੀ ਪਿਆਰ ਨਾਲ਼ ਬੋਲਦੇ ਹਨ ਕਿ ਕਿਸੇ ਦੂਜੇ ਨੂੰ ਐਵੇਂ ਲੱਗਦਾ ਹੀ ਨਹੀਂ ਕਿ ਉਹ ਕਿਸੇ ਓਪਰੇ ਬੰਦੇ ਨਾਲ਼ ਗੱਲ ਕਰ ਰਿਹਾ ਹੋਵੇ ਅਤੇ ਦੂਜੀ ਪੰਜਾਬੀ ਆਪਣੀ ਗੁਰੂਆਂ ਦੁਆਰਾ ਘੜੀ ਹੋਈ ਭਾਸ਼ਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜੋ ਗੁਰੂਆਂ ਦੀ ਬਾਣੀ ਹੈ ਉਹ ਪੰਜਾਬੀ ਵਿੱਚ ਹੀ ਦਰਜ ਹੈ ਅਤੇ ਹਿੰਦੀ ਹੈ ਜਿਵੇਂ ਸਿਰਫ ਹਿੰਦੀ ਆਪਣੇ ਇੰਡੀਆ ਵਿੱਚ ਹੀ ਬੋਲੀ ਜਾਂਦੀ ਹੈ ਬਟ ਜੋ ਪੰਜਾਬੀ ਹੈ ਉਹ ਐਬਰੋਡ ਜਿਵੇਂ ਕੈਨੇਡਾ ਆਸਟ੍ਰੇਲੀਆ ਇਹ ਸਾਰੇ ਦੂਜੇ ਹੋਰ ਮੁਲਕਾਂ ਵਿੱਚ ਵੀ ਫੈਲੀ ਹੋਈ ਹੈ ਅੱਜ ਕੱਲ੍ਹ ਹਰੇਕ ਦਸਵਾਂ ਬੰਦਾ ਜੋ ਹੈ ਉਹ ਪੰਜਾਬੀ ਬੋਲਦਾ ਹੀ ਹੈ ਪਾਕਿਸਤਾਨ ਵਿੱਚ ਸਭ ਤੋਂ ਵੱਧ ਪੰਜਾਬੀ ਬੋਲੀ ਜਾਂਦੀ ਹੈ ਅਤੇ ਪਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਜੋ ਪੰਜਾਬੀ ਨੂੰ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਉਹ ਹਜੇ ਤੱਕ ਉਨਾਂ ਨਹੀਂ ਮਿਲਿਆ ਜਿੰਨਾਂ ਹੋਰ ਭਾਸ਼ਾਵਾਂ ਨੂੰ ਮਿਲਿਆ ਹੋਇਆ ਹੈ ਅਤੇ ਜੋ ਪੰਜਾਬ ਦੇ ਅੱਜ ਕੱਲ੍ਹ ਪੰਜਾਬ ਦੇ ਪੰਜਾਬ ਵਿੱਚੋਂ ਹੀ ਮੁੱਖ ਮੰਤਰੀ ਮਨਿਸਟਰਸ ਬਹੁਤ ਤਰੱਕੀ 'ਤੇ ਹਨ ਅਤੇ ਉਹ ਪੰਜਾਬੀ ਨੂੰ ਪ੍ਰਮੋਟ ਵੀ ਕਰ ਰਹੇ ਹਨ ਤਾਂ ਮੇਰੀ ਇਹ ਹੀ ਉਮੀਦ ਹੈ ਕਿ ਜੋ ਅੱਜ ਅੱਜ ਦੀ ਸਾਰੀ ਆਪਣੀ ਯੁਵਾ ਨੌਜਵਾਨ ਪੀੜ੍ਹੀ ਹੈ ਉਹ ਪੰਜਾਬੀ ਨੂੰ ਉਸਦਾ ਅਸਲੀ ਮਾਣ ਦਿਵਾਉਣ 'ਚ ਸਫਲ ਹੋਣ